ਪੰਜਾਬ ਵਿੱਚ ਸਥਾਨਕ ਕਾਰੋਬਾਰ ਬਹੁਤ ਹੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹਨ ਅਤੇ ਬਹੁਤ ਵਧੀਆ ਚੱਲਦੇ ਆ ਰਹੇ ਹਨ ਪਰ ਕੁਛ ਸਮੇਂ ਦੀ ਚੇਂਜਿਸ ਦੇ ਨਾਲ ਸਮੇਂ ਦੇ ਬਦਲਣ ਕਰਕੇ ਕੋਂਪੀਟੀਸ਼ਨ ਬਹੁਤ ਜ਼ਿਆਦਾ ਹੀ ਆ ਚੁੱਕਾ ਹੈ ਪੰਜਾਬ ਵਿੱਚ ਪੂਰੇ ਹੀ ਭਾਰਤ ਵਿੱਚ ਮਲਟੀਨੈਸ਼ਨਲ ਕੰਪਨੀਸ ਆ ਚੁੱਕੀਆਂ ਹਨ ਅਗਰ ਆਪਾਂ ਖਾਣ ਪੀਣ ਦੇ ਖੇਤਰ ਵਿੱਚ ਹੀ ਦੇਖੀਏ ਤਾਂ ਪੁਰਾਣੇ ਸਮੇਂ ਵਿੱਚ ਹਲਵਾਈ ਦੀਆਂ ਦੁਕਾਨਾਂ ਹੁੰਦੀਆਂ ਸਨ ਓਹ ਵੀ ਗਿਣਵੀਆਂ ਚੁਣਵੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਆਪਾਂ ਤਰਨਤਾਰਨ ਸ਼ਹਿਰ ਦੀ ਗੱਲ ਹੀ ਕਰੀਏ ਤਾਂ ਇੱਥੇ ਡੋਮੀਨੋਸ ਸਬਵੇਅ ਸਟਾਰਬਕਸ ਤਕਰੀਬਨ ਸਾਰੀਆਂ ਕੰਪਨੀਸ ਕੁਝ ਆ ਚੁੱਕੀਆਂ ਹਨ ਅਤੇ ਕੁਝ ਸੈਟਅਪ ਹੋਣ ਵਾਲੀਆਂ ਹਨ ਜਿਹਦੇ ਨਾਲ ਕਿ ਲੋਕਲ ਵੈਂਡਰਸ ਅਤੇ ਲੋਕਲ ਹਲਵਾਈਆਂ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਨੂੰ ਜਾਂ ਜਿਨ੍ਹਾਂ ਦੇ ਫਾਸਟ ਫੂਡ ਦੇ ਵਪਾਰ ਸੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈ ਇੱਦਾਂ ਹੀ ਕੱਪੜੇ ਦੇ ਕਾਰੋਬਾਰ ਨੂੰ ਵੀ ਬਹੁਤ ਜ਼ਿਆਦਾ ਘਾਟਾ ਪਿਛਲੇ ਸਮੇਂ 'ਚ ਹੋਇਆ ਕਿਉਂਕਿ ਇੱਥੇ ਬਹੁਤ ਸਾਰੇ ਸ਼ੋਅਰੂਮ ਆਏ ਜਿਵੇਂ ਕਿ ਰੈੱਡ ਟੇਪ ਮੋਂਟੇ ਕਾਰਲੋ ਸਪੋਰਟ ਕਿੰਗ ਐਡੀਡਾਸ ਹਾਰਲੇ ਡੇਵਡਸਨ ਕਲੋਥਿੰਗ ਜਿਹਦੇ ਨਾਲ ਕਿ ਲੋਕਲ ਜਿੰਨੀਆਂ ਦੁਕਾਨਾਂ ਸੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਘਾਟਾ ਹੋਇਆ ਪਰ ਕੁਛ ਸਮੇਂ ਤੋਂ ਬਾਅਦ ਜਦੋਂ ਲੋਕਾਂ ਨੂੰ ਉਸ ਚੀਜ਼ ਦੀ ਜਾਗਰੂਕਤਾ ਆਈ ਅਵੇਅਰਨੈਂਸ ਆਈ ਕਿ ਕਿਵੇਂ ਆਪਾਂ ਕੋਂਪੀਟੀਸ਼ਨ ਨੂੰ ਲੜ ਸਕਦੇ ਹਾਂ ਅਤੇ ਲੋਕਾਂ ਨੂੰ ਬੜੇ ਹੀ ਦਿਮਾਗ਼ ਨਾਲ ਆਪਣੇ ਕੰਮ ਨੂੰ ਕੋਂਪੀਟੀਸ਼ਨ ਨੂੰ ਫੇਸ ਕੀਤਾ ਅਤੇ ਕੰਮ ਵਿੱਚ ਵਾਧਾ ਪਾਇਆ ਜਿਵੇਂ ਕਿ ਉਨ੍ਹਾਂ ਨੇ ਵੱਖਰੇ ਵੱਖਰੇ ਡਿਸਕਾਊਂਟਸ ਲਗਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਬਾਏ ਵਨ ਗੈੱਟ ਵਨ ਦੀ ਔਫ਼ਰ ਲਗਾ ਦਿੱਤੀ ਦੀਵਾਲੀ ਬੰਪਰ ਅਤੇ ਹੋਰ ਸਾਰੀਆਂ ਔਫ਼ਰਸ ਲਗਾ ਦਿੱਤੀਆਂ ਜਿਹਦੇ ਨਾਲ ਕਿ ਕਸਟਮਰਸ ਵੇਖ ਕੇ ਐਟ੍ਰੈਕਟ ਹੁੰਦੇ ਹਨ ਅਤੇ ਚੀਜ਼ ਨੂੰ ਖ਼ਰੀਦ ਲੈਂਦੇ ਹਨ